ਮੈਂ ਵਰਿੰਦਰ ਕੁਮਾਰ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਮੌਸਮ ਦੇ ਅਨੁਸਾਰ ਸਾਡੀ ਧਰਤੀ 'ਤੇ ਵੱਖ ਵੱਖ ਤਰ੍ਹਾਂ ਦੇ ਕੀੜੇ ਮਕੌੜੇ ਵੀ ਪੈਦਾ ਹੁੰਦੇ ਹਨ

ਵਾਤਾਵਰਨ ਅਨੁਕੂਲ ਕੀੜਾ ਮਕੌੜਾ ਹੈ ਉਹ ਆਪਣੇ ਮੌਸਮ ਦੇ ਅਕੋਰਡਿੰਗ ਧਰਤੀ 'ਤੇ ਆ ਜਾਂਦਾ ਹੈ ਅਤੇ ਉਹ ਜਿਹੜੇ ਕੀੜੇ ਮਕੌੜੇ ਹਨ ਉਹ ਸਾਡੇ ਫਸਲਾਂ ਨੂੰ ਵੀ ਕਈ ਤਰ੍ਹਾਂ ਨਾਲ ਪ੍ਰਭਾਵਿਤ ਕਰਦੇ ਹਨ ਫਸਲਾਂ ਦਾ ਨੁਕਸਾਨ ਕਰਦੇ ਹਨ ਫਿਰ ਵੀ ਫਸਲਾਂ ਨੂੰ ਬਚਾਉਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਬਚਾਉਣਾ ਚਾਹੀਦਾ ਵੀ ਜੇ ਕੀੜੇ ਮਕੌੜੇ ਉਹ ਸਾਡੇ ਉਹਨਾਂ ਨੂੰ ਵੀ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਫਸਲਾਂ ਦੇ ਨਾਲ ਨਾਲ ਕੀੜੇ ਮਕੌੜਿਆਂ ਦਾ ਹੋਣਾ ਵੀ ਜ਼ਰੂਰੀ ਹੈ ਜੋ ਕੀੜੇ ਮਕੌੜੇ ਮੰਨ ਲਉ ਸਾਡੇ ਵਾਤਾਵਰਨ ਅਨਕੂਲ ਹਨ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਹੈ ਉਹਨਾਂ ਕੀੜੇ ਮਕੌੜਿਆਂ ਨੂੰ ਪ੍ਰਭਾਵਿਤ ਨਹੀਂ ਹੋਣ ਦੇਣਾ ਚਾਹੀਦਾ ਅਸੀਂ ਕਈ ਤਰ੍ਹਾਂ ਦੀਆਂ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਕੇ ਫਸਲਾਂ ਨੂੰ ਪ੍ਰਭਾਵਿਤ ਕਰ ਰਹੇ ਹਾਂ ਉਸਦੇ ਨਾਲ ਨਾਲ ਕੀੜੇ ਮਕੌੜੇ ਵੀ ਖਤਮ ਹੋ ਰਹੇ ਹਨ

ਕੀੜੇ ਮਕੌੜੇ ਜੋ ਸਾਡੇ ਲਈ ਲਾਭਦਾਇਕ ਹਨ ਉਹ ਵੀ ਉਹਨਾਂ 'ਤੇ ਵੀ ਇਹਨਾਂ ਕੀੜੇਮਾਰ ਦਵਾਈਆਂ ਕਾਰਨ ਬਹੁਤ ਅਸਰ ਪੈ ਰਿਹਾ ਹੈ ਜੋ ਕਿ ਅੱਜ ਅਲੋਪ ਹੋ ਰਹੇ ਹਨ ਸਾਨੂੰ ਚਾਹੀਦਾ ਹੈ ਵੀ ਫਸਲਾਂ ਉਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਹਨ ਜਿਨ੍ਹਾਂ ਨੂੰ ਘੱਟ ਕੀੜੇ ਮਾਰ ਦਵਾਈਆਂ ਦੀ ਜ਼ਰੂਰਤ ਹੋਵੇ ਤਾਂ ਇਸ ਤਰ੍ਹਾਂ ਸਾਡੇ ਜੋ ਜ਼ਰੂਰੀ ਕੀੜੇ ਮਕੌੜੇ ਹਨ ਉਹ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ ਉਹਨਾਂ 'ਤੇ ਕਿਸੇ ਤਰ੍ਹਾਂ ਦਾ ਕੋਈ ਬੁਰਾ ਅਸਰ ਨਹੀਂ ਹੋਣਾ ਚਾਹੀਦਾ ਧੰਨਵਾਦ